ਖੇਡਾਂ ਦਾ ਜ਼ਿੰਦਗੀ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਹੈ ਜਿਹੜੀਆਂ ਖੇਡਾਂ ਉਹ ਜ਼ਿੰਦਗੀ ਦਾ ਇੱਕ ਹਿੱਸਾ ਹੁੰਦੀਆਂ ਨੇ ਖੇਡਾਂ ਦੇ ਨਾਲ ਸਰੀਰਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ ਖੇਡਾਂ ਨਾਲ ਬੱਚੇ ਜਿਹੜੇ ਆ ਉਹ ਨਸ਼ਿਆਂ ਤੋਂ ਦੂਰ ਰਹਿੰਦੇ ਆ ਅਵਾਰਾਗਰਦੀ ਕਰਨ ਤੋਂ ਦੂਰ ਰਹਿੰਦੇ ਆ ਉਹ ਮੋਬਾਈਲਾਂ ਤੋਂ ਦੂਰ ਰਹਿੰਦੇ ਆ ਖੇਡਾਂ ਨਾਲ ਉਹਨਾਂ ਦਾ ਸਰੀਰਿਕ ਵਿਕਾਸ ਵੀ ਹੁੰਦਾ ਹੈ ਉਹ ਮਜ਼ਬੂਤ ਬਣਦੇ ਆ ਖੇਡਾਂ ਨਾਲ ਇੱਕ ਖਿਡਾਰੀ ਜਿਹੜਾ ਹੈ ਬੱਚਾ ਹੈ ਉਹ ਇੱਕ ਵਧੀਆ ਖਿਡਾਰੀ ਬਣ ਜਾਂਦਾ ਹੈ ਭਾਰਤ ਦੇ ਵਿੱਚ ਸਰਕਾਰ ਨੂੰ ਖੇਡਾਂ ਉਤਸ਼ਾਹਿਤ ਕਰਨ ਦੇ ਲਈ ਬਹੁਤ ਸਾਰੇ ਉਪਰਾਲੇ ਕਰਨੇ ਚਾਹੀਦੇ ਹਨ ਜਿਵੇਂ ਉਹ ਚੰਗੇ ਖਿਡਾਰੀਆਂ ਨੂੰ ਮੌਕਾ ਦੇਣ ਤਾਂ ਕਿ ਉਹ ਆਪਣਾ ਅੰਦਰਲਾ ਕਰਤੱਬ ਦਿਖਾ ਕਰਤੱਵ ਦਿਖਾ ਕੇ ਦਿਖਾ ਸਕਣ ਅਤੇ ਸਰਕਾਰ ਖਿਡਾਰੀਆਂ ਨੂੰ ਮੌਕਾ ਦਵੇ ਅਤੇ ਉਹਨਾਂ ਨੂੰ ਸਨਮਾਨਿਤ ਵੀ ਕਰੇ ਇਨਾਮ ਦਵੇ ਪੈਸੇ ਦਵੇ ਉਹਨਾਂ ਦਾ ਆਰਥਿਕ ਪੱਖ ਜਿਹੜਾ ਸਹੀ ਕਰੇ ਅਤੇ ਨੌਕਰੀਆਂ ਵੀ ਦਵੇ ਤਾਂ ਕਿ ਇਹਨਾਂ ਦਾ ਆਰਥਿਕ ਪੱਖ ਜਿਹੜਾ ਹੈ ਉਹ ਸਹੀ ਹੋ ਸਕੇ ਸਰਕਾਰ ਨੂੰ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਇਸ ਦੇ ਨਾਲ ਹੋਰ ਵੀ ਬੱਚੇ ਉਹਨਾਂ ਖਿਡਾਰੀਆਂ ਵੱਲ ਵੇਖ ਕੇ ਉਤਸ਼ਾਹਿਤ ਹੋਣਗੇ ਅਤੇ ਖੇਡਾਂ ਖੇਡਣਗੇ ਅਤੇ ਖੇਡਾਂ ਵਿੱਚ ਹਿੱਸਾ ਲੈਣਗੇ ਅਤੇ ਚੰਗੇ ਖਿਡਾਰੀ ਬਣਨਗੇ ਇਸ ਨਾਲ ਸਾਡੇ ਦੇਸ਼ ਦਾ ਨਾਮ ਵੀ ਰੋਸ਼ਨ ਹੋਵੇਗਾ